ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੱਸੋ ਜੀ ਹਾਂਜੀ ਮੈਂ ਸਟੇਸ਼ਨਰੀ ਤੁਹਾਡੇ ਤੋਂ ਬੁਕਸ ਲੈਣੀਆਂ ਸੀਗੀਆਂ ਜੀ ਹਾਂਜੀ ਤੁਸੀਂ ਰੇਟ ਦੀ ਡਿਟੇਲ ਦੱਸ ਦਿਓ ਅਤੇ ਮੈਨੂੰ ਬੁਕਸ ਤੁਸੀਂ ਭੇਜ ਦੇਣਾ ਹਾਂਜੀ ਹਾਂਜੀ ਅਸੀਂ ਪਹਿਲਾਂ ਵੀ ਬੁੱਕਸ ਲਈਆਂ ਸੀ ਪਰ ਸਾਨੂੰ ਉਹਨਾਂ ਦੀ ਕੁਆਲਿਟੀ ਵਧੀਆ ਨਹੀਂ ਮਿਲੀ ਸੀ ਸਾਨੂੰ ਵਧੀਆ ਕੁਆਲਿਟੀ ਚਾਹੀਦੀ ਹੈ ਜੀ ਮੈਨੂੰ ਬੁੱਕਸ ਚਾਹੀਦੀਆਂ ਨੇ ਬੀ ਏ ਥਰਡ ਸਮੈਸਟਰ ਦੀਆਂ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਮੈਨੂੰ ਡਿਟੇਲ ਦੱਸ ਸਕਦੇ ਹੋ ਬੁਕਸ ਦੀ ਅਤੇ ਰੇਟ ਵਗੈਰਾ ਹੈਲੋ ਠੀਕ ਹੈ ਜੀ ਓਕੇ ਜੀ ਹੋਰ ਸਾਨੂੰ ਤੁਸੀਂ ਨਾਲ ਈ ਟੀ ਟੀ ਦੀਆਂ ਵੀ ਬੁੱਕਸ ਭੇਜ ਸਕਦੇ ਹੋ ਕਿ ਹਾਂਜੀ ਉਹ ਵੀ ਭੇਜ ਦੇ ਕਦੋਂ ਤੱਕ ਤੁਸੀਂ ਭੇਜ ਦਓਗੇ

ਹਾਂਜੀ ਤੁਸੀਂ ਇੱਕ ਤਾਂ ਸਾਨੂੰ ਬੀ ਏ ਥਰਡ ਸਮੈਸਟਰ ਦੀ ਹਾਂਜੀ ਜੇਕਰ ਤੁਹਾਡੀ ਬੁੱਕਸ ਦੀ ਕੁਆਲਿਟੀ ਵਧੀਆ ਨਾ ਹੋਈ ਤਾਂ ਅਸੀਂ ਰਿਟਰਨ ਕਰ ਸਕਦੇ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਜੀ

ਹਾਂਜੀ ਓਕੇ ਓਕੇ ਜੀ ਥੈਂਕ ਯੂ